ਹੈਲੋ ਹਾਂਜੀ ਜੇ ਆਪਾਂ ਪੰਜਾਬੀ ਭਾਸ਼ਾ ਬਾਰੇ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀਆਂ ਕਿ ਚੁਣੋਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤਾਂ ਉਹ ਆਪਣੇ ਸਕੂਲ ਪ੍ਰਤੀ ਹੈਗਾ ਹੈ ਨਾ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਪੰਜਾਬੀ ਬਿਲਕੁਲ ਵੀ ਬੋਲਣੀ ਨਹੀਂ ਆਉਂਦੀ ਹੈਗੀ ਜਿਹੜੀ ਕਿ ਆਪਣੀ ਮਾਤਰ ਭੂਮੀ ਪੰਜਾਬੀ ਹੈ ਜੋ ਕਿ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੈ ਤਾਂ ਬੱਚਿਆਂ ਨੂੰ ਪੰਜਾਬੀ ਕਿਉਂ ਨਹੀਂ ਲਗਾਈ ਜਾਂਦੀ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਖਾਸ ਤੌਰ 'ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਕਿ ਹਿੰਦੀ ਨੂੰ ਅਤੇ ਜ਼ਿਆਦਾ ਇੰਗਲਿਸ਼ ਨੂੰ ਜਿਹੜੀ ਕਿ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਪੰਜਾਬੀ ਨੂੰ ਕਿਉਂ ਨਹੀਂ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹੁੰਦੇ ਵੀ ਆਪਾਂ ਇੰਗਲਿਸ਼ ਨੂੰ ਜ਼ਿਆਦਾ ਮਹੱਤਤਾ ਦਿੰਦੇ ਹਾਂ ਕਿਉਂਕਿ ਇੰਗਲਿਸ਼ ਦਾ ਬੱਚਿਆਂ ਨੂੰ ਆਉਂਦੀ ਹੈਗੀ ਆ ਪੰਜਾਬੀ ਆਉਂਦੀ ਨਹੀਂ ਹੈਗੀ ਆਮ ਤੌਰ 'ਤੇ ਜੇ ਆਪਾਂ ਸੋਚੀਏ ਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੇਵੀਂ ਤੋਂ ਬਾਅਦ ਜਿਹੜੀ ਹੈਗੀ ਆ ਕਿ ਪੰਜਾਬੀ ਅਲਾਓ ਕੀਤੀ ਜਾਂਦੀ ਹੈ ਕਿਉਂਕਿ ਉਦੋਂ ਤੱਕ ਬੱਚਿਆਂ ਦਾ ਜਿਹੜਾ ਕਿ ਐਕਸਪੀਰੀਅੰਸ ਹੁੰਦਾ ਹੈਗਾ ਵੀ ਬੋਲਣ ਦਾ ਤਰੀਕਾ ਹੁੰਦਾ ਉਹ ਇੰਗਲਿਸ਼ ਜਾਂ ਹਿੰਦੀ ਵੱਲ ਜ਼ਿਆਦਾ ਪੈ ਜਾਂਦਾ ਤਾਂ ਫਿਰ ਉਹ ਛੇਵੀਂ ਕਲਾਸ ਜਿਹੜੀ ਕਿ ਬੱਚੇ ਨੂੰ ਜਿਹੜੀ ਪੰਜਾਬੀ ਲਿਖਣ 'ਚ ਪੜ੍ਹਨ 'ਚ ਅਤੇ ਬੋਲਣ 'ਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਆ ਆਮ ਤੌਰ 'ਤੇ ਕਈ ਤਰੀਕਿਆਂ ਨਾਲ ਦੇਖਿਆ ਜਾਂਦਾ ਕਿ ਅੱਜ ਕੱਲ੍ਹ ਬੱਚਿਆਂ ਨੂੰ ਸਿਰਫ ਇੰਗਲਿਸ਼ ਹੀ ਪੜ੍ਹਨੀ ਆਉਂਦੀ ਆ ਹਿੰਦੀ ਪੜ੍ਹਨੀ ਆਉਂਦੀ ਹੈ ਪੰਜਾਬੀ ਵੱਲ ਕੋਈ ਧਿਆਨ ਨਹੀਂ ਹੈਗਾ ਬੱਚਿਆਂ ਦਾ ਤਾਂ ਕਿ ਥੋੜ੍ਹਾ ਜਿਹਾ ਬਦਲਾਵ ਆਉਣਾ ਚਾਹੀਦਾ ਹੈਗਾ ਕਿ ਬੱਚਿਆਂ ਨੂੰ ਜਿਹੜੀ ਕਿ ਪੰਜਾਬੀ ਪੜ੍ਹਾਉਣੀ ਲਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਸਕੂਲ ਦੇ ਬੱਚਿਆਂ ਨੂੰ